ਗੁਡ ਮੌਰਨਿੰਗ ਹਾਂਜੀ ਕਿਹੜੇ ਕਿਹੜੇ ਹੈ ਮੈਮ ਦੱਸੋਗੇ ਹਾਂਜੀ ਠੀਕ ਹੈ ਹਾਂਜੀ ਠੀਕ ਹੈ ਸਿਕਸ ਪੁਆਇੰਟ ਸਿਕਸ ਵਿੱਚ ਠੀਕ ਹੈ ਓਕੇ

ਠੀਕ ਹੈ ਹੋਰ ਇਸ ਤੋਂ ਇਲਾਵਾ ਹਾਂਜੀ ਠੀਕ ਹੈ ਮੈਮ ਇਹ ਜਿਹੜੀ ਤੁਸੀਂ ਮੈਨੂੰ ਦੱਸਦੇ ਪਏ ਹੋ ਪੋਲਿਸਿਸ ਬਾਰੇ ਇਹਦੇ ਬਾਰੇ ਮੈਂ ਆਪਣੇ ਘਰ ਡਿਸਕਸ ਕਰਾਂਗੀ ਅਤੇ ਫਿਰ ਤੁਹਾਨੂੰ ਦੱਸਾਂਗੀ ਕਿ ਲੈਣੀ ਜਾਂ ਨਹੀਂ ਲੈਣੀ ਹੈ ਨਾ ਠੀਕ ਠੀਕ ਓਕੇ ਮੈਮ ਥੈਂਕ ਯੂ